ਮਿਊਚੁਅਲ ਫ਼ੰਡ ਇੱਕ ਬਹੁਤ ਚੰਗੀ ਸੇਵਿੰਗ ਸਕੀਮ ਹੈ ਉਸ 'ਚ ਤੁਸੀਂ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਵਾਸਤੇ ਉਨ੍ਹਾਂ 'ਚ ਪੈਸਾ ਨਿਵੇਸ਼ ਕਰ ਸਕਦੇ ਹੋ ਔਰ ਉਹ ਨਿਵੇਸ਼ ਕਰਨਾ ਇਸ ਕਰਕੇ ਜ਼ਰੂਰੀ ਹੈ ਕਿ ਭਵਿੱਖ 'ਚ ਕੋਈ ਆਫਤਾਂ ਆਣ ਪਵੇ ਤਾਂ ਤੁਹਾਡੇ ਕੋਲ ਉਹ ਪੈਸਾ ਸੇਫ ਪਿਆ ਹੁੰਦਾ ਹੈ ਅਤੇ ਮਿਊਚੁਅਲ ਫ਼ੰਡ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਤਾਂ ਲੰਬਸਮ ਅਤੇ ਇੱਕ ਸਿਪ ਸਿਪ ਤਿੰਨ ਤਰ੍ਹਾਂ ਦਾ ਹੁੰਦਾ ਹੈ ਇਹ ਵੀਕਲੀ ਵੀ ਹੈ ਡੇਲੀ ਵੀ ਹੈ ਅਤੇ ਮੰਥਲੀ ਵੀ ਹੈ ਅਤੇ ਲੰਬਸਮ ਜਿਹੜੀ ਹੈ ਉਹ ਇੱਕੋ ਟਾਈਮ ਨਿਵੇਸ਼ ਕਰਨਾ ਹੁੰਦਾ ਹੈ ਇੱਕੋ ਵਾਰੀ ਤੁਸੀਂ ਉਹ ਪੈਸੇ ਦਿੰਦੇ ਹੋ ਅਤੇ ਜਿੰਨੀ ਦੇਰ ਚਾਹੋ ਤੁਸੀਂ ਉਸ ਨੂੰ ਉਹਦੇ 'ਚ ਰੱਖ ਸਕਦੇ ਹੋ ਔਰ ਵੈਸੇ ਜਦੋਂ ਚਾਹੋ ਤੁਸੀਂ ਉਹਨੂੰ ਨਿਕਲਵਾ ਵੀ ਸਕਦੇ ਹੋ ਕੁਛ ਇਹਦਾ ਫਿਕਸਡ ਟਾਈਮ ਹੁੰਦਾ ਹੈ ਓਨੀ ਦੇਰ ਇਹਨੂੰ ਰੱਖ ਕੇ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਨਿਕਲਵਾ ਸਕਦੇ ਹੋ ਮਿਊਚੁਅਲ ਫ਼ੰਡ ਜ਼ਰੂਰੀ ਇਸ ਕਰਕੇ ਹੈ ਕਿ ਇਹ ਤੁਹਾਡੇ ਭਵਿੱਖ ਨੂੰ ਸੁਰੱਖਿਅਤ ਕਰਦਾ ਹੈ ਤੁਹਾਡੇ ਪਰਿਵਾਰ ਨੂੰ ਜਦੋਂ ਵੀ ਭਵਿੱਖ 'ਚ ਲੋੜ ਪੈਂਦੀ ਹੈ ਪੈਸੇ ਦੀ ਕੋਈ ਮੈਡੀਕਲ ਦੀ ਜ਼ਰੂਰਤ ਹੈ ਕੋਈ ਬਿਮਾਰੀ ਵਿੱਚ ਜ਼ਰੂਰਤ ਹੈ ਜੇ ਬੱਚੇ ਵੱਡੇ ਹੋ ਰਹੇ ਹਨ ਉਨ੍ਹਾਂ ਦੀ ਪੜ੍ਹਾਈ ਵਾਸਤੇ ਜ਼ਰੂਰੀ ਹੈ ਜੇ ਤੁਸੀਂ ਮਕਾਨ ਬਣਾਉਣਾ ਹੈ ਉਸ ਵਾਸਤੇ ਪੈਸਾ ਚਾਹੀਦਾ ਹੈ ਅਤੇ ਮਿਊਚੁਅਲ ਫ਼ੰਡ ਵਿੱਚ ਨਿਵੇਸ਼ ਕੀਤਾ ਪੈਸਾ ਤੁਹਾਡੇ ਬਹੁਤ ਕੰਮ ਆਉਂਦਾ ਹੈ ਇਸ ਕਰਕੇ ਇਹਦੇ 'ਚ ਨਿਵੇਸ਼ ਕਰਨਾ ਚਾਹੀਦਾ ਹੈ ਇਹ ਮਾਰਕੀਟ ਦੀ ਜਾਂ ਮਾਰਕੀਟ ਦੇ ਉੱਤੇ ਨਿਰਭਰ ਕਰਦਾ ਹੈ ਜਿਹੜਾ ਪੈਸਾ ਤੁਸੀਂ ਨਿਵੇਸ਼ ਕਰਦੇ ਹੋ ਉਹ ਮਾਰਕੀਟ 'ਚ ਅਲੱਗ ਅਲੱਗ ਚੀਜ਼ਾਂ 'ਤੇ ਉਹ ਇਨਵੈਸਟ ਕੀਤਾ ਜਾਂਦਾ ਹੈ ਔਰ ਉਸ 'ਤੇ ਉਰਾ ਉਤਾਰ ਚੜ੍ਹਾਅ ਵੀ ਹੁੰਦਾ ਹੈ ਇਹਦੇ 'ਚ ਪਰ ਆਮ ਤੌਰ 'ਤੇ ਇਹਦੇ 'ਚ ਫਾਇਦਾ ਹੀ ਦਿਖਦਾ ਹੈ ਔਰ ਬੈਂਕਾਂ ਨਾਲੋਂ ਬੈਂਕਾਂ 'ਚ ਨਿਵੇਸ਼ ਕਰਨ ਨਾਲੋਂ ਇਸ 'ਚ ਜ਼ਿਆਦਾ ਤੁਹਾਨੂੰ ਫਾਇਦਾ ਮਿਲਦਾ ਹੈ ਇਸ ਕਰਕੇ ਇਹਦੇ 'ਚ ਨਿਵੇਸ਼ ਕਰਨਾ ਚਾਹੀਦਾ ਹੈ